ਹਾਂਜੀ ਹਾਂਜੀ ਹਾਂਜੀ ਹਾਂਜੀ ਆਪਣੀ ਘੰਟਾ ਘਰ ਦੇ ਰਾਸਤੇ ਚ ਹੀ ਆ ਹਾਂਜੀ ਹਾਂਜੀ ਆਪਦੀ ਸ਼ੋਪ ਹੀ ਹੈ ਹਾਂਜੀ ਦੱਸੋ ਕਿਸ ਕੰਪਨੀ ਦਾ ਲੈਣਾ ਚਾਹੋਗੇ ਆਪਣੇ ਕੋਲ ਤਕਰੀਬਨ ਸਾਰੇ ਹੀ ਐ ਐਮ ਆਈ ਵੀਵੋ ਵਨ ਪਲੱਸ ਤੇ ਸਮੈਸੰਗ ਦੇ ਸਟਾਰਟਿੰਗ ਚਾਰ ਹਜ਼ਾਰ ਤੋਂ ਐ ਵੱਧ ਤੋਂ ਵੱਧ ਤਾਂ ਕਾਫੀ ਰੇਟ ਤੱਕ ਦੇ ਪਏ ਐ ਹਾਂਜੀ ਕਲਰ ਬਲੂ ਹੈਗਾ ਬਲੈਕ ਐ ਗੋਲਡਨ ਕਲਰ ਹੈ ਬਹੁਤ ਸੁੰਦਰ ਕਲਰ ਹੈ ਆ ਹਾਂਜੀ ਫੀਚਰਸ ਕੈਮਰਾ ਕੁਆਲਟੀ ਬਹੁਤ ਅੱਛੀ ਹੈ ਪਕੜਨ ਚ ਵਧੀਆਂ ਐ ਸਮੂਦ ਤੇ ਚਲਾਣ ਚ ਤਕਰੀਬਨ ਬਹੁਤ ਅੱਛੀ ਇਹਨਾਂ ਦੀ ਔਰ ਕਵਰ ਵੀ ਬਹੁਤ ਇਜ਼ੀਲੀ ਅਵੇਲੇਬਲ ਉਹਨਾਂ ਕੋਲ ਸਾਰਾ ਪਾਰਟ ਉਹਨਾਂ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਆਪਾਂ ਕੰਟੈਕਟ ਹੈਗੇ ਆਪਣੇ ਨਾਲ ਤੁਹਾਨੂੰ ਬੈਟਰ ਫੀਲ ਕਰੋ ਆਪਾਂ ਨੂੰ ਕਲੀਅਰ ਕਰਾ ਈ ਐਮ ਆਈ ਦੇ ਡਿਫਰੈਂਟ ਪਲੈਨ ਹੈਗੇ ਨੇ ਕੋਈ ਦੋ ਹਜ਼ਾਰ ਤੋਂ ਸਟਾਰਟ ਏ ਕੋਈ ਹਜ਼ਾਰ ਤੋਂ ਵੀ ਸਟਾਰਟ ਏ ਫਿਰ ਟਾਈਮ ਪੀਰੀਅਡ ਵਧਦਾ ਜਾਂਦਾ ਅਲੱਗ ਅਲੱਗ ਟਾਈਮ ਪੀਰੀਅਡ ਦੇ ਹੈਗੇ ਆ ਇੰਟਰਸਟ ਥੋੜਾ ਬਹੁਤਾ ਨੀ ਮੀਨੀਮਮ ਜਾ ਹੈਗਾ ਵੈਸੇ ਜ਼ੀਰੋ ਪਰਸੈਟ ਵੀ ਹੈਗਾ ਥੋਨੂੰ ਵਧੀਆਂ ਤੋਂ ਵਧੀਆਂ ਪਰੋਵਾਈਡ ਕਰਵਾਵਾਂਗੇ ਨਹੀਂ ਨਹੀਂ ਕੋਈ ਕੰਪਲੇਂਟ ਨਹੀਂ ਅਗਰ ਕੋਈ ਆਏਗੀ ਤਾਂ ਆਪਾਂ ਬੈਠੇ ਆਂ ਕਿਉਂਕਿ ਇੱਥੇ ਆ ਕੇ ਤੁਹਾਨੂੰ ਮਿਲ ਸਕਦੇ ਹੋ ਜਾਂ ਤੁਹਾਡੀ ਕੰਪਲੇਂਟ ਨੂੰ ਜਰੂਰ ਹੱਲ ਕਰਾਵਾਂਗੇ ਨਹੀਂ ਨਹੀਂ ਬਿਲਕੁਲ ਪ੍ਰੋਗਰਾਮ ਹਾਂਜੀ ਹਾਂਜੀ ਸ਼ੋ ਸ਼ੋਪ ਤੇ ਤੁਸੀਂ ਮਿਲ ਸਕਦੇ ਹੋ ਨੌਂ ਵਜੇ ਤੋਂ ਲੈ ਕੇ ਤੋਂ ਬਾਅਦ ਸ਼ਾਮ ਤੱਕ ਰਾਤ ਦੇ ਨੌਂ ਵਜੇ ਤੱਕ ਖੁੱਲੀ ਹੁੰਦੀ ਐ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਹਾਂਜੀ ਨਹੀਂ ਨਹੀਂ ਬਿਲਕੁਲ ਸਭ ਕੁਝ ਤੁਹਾਨੂੰ ਦੋ ਮਿਲੂਗਾ ਤੁਸੀਂ ਆਪੀ ਤੁਹਾਨੂੰ ਅਵੇਲੇਬਲ ਕਰਾਇਆ ਜਾ ਫਰਕ ਦੋ ਚਾਰਜਰ ਹੋਊਗਾ ਉਹਨਾਂ ਦੇ ਅਗਰ ਅਸੀਂ ਲੇਟ ਫਿਰ ਹੁੰਦੀ ਹਾਂਜੀ ਹਾਂਜੀ ਜਰੂਰ ਤੁਸੀਂ ਵਿਜਿਟ ਕਰਨਾ ਸ਼ੁਰੂ ਤੇ ਠੀਕ ਐ ਸ਼ੁਕਰੀਆ ਅੱਛਾ